ਹੈਲੋ ਡੋਕਟਰ ਸਾਹਿਬ ਬੋਲਦੇ ਪਏ ਸਰ ਮੈਨੂੰ ਨਾ ਜ਼ੁਕਾਮ ਬੁਖਾਰ ਬਹੁਤ ਆ ਅਤੇ ਮੇਰੀ ਬਹੁਤ ਮਾੜੀ ਕੰਡੀਸ਼ਨ ਆ ਮੇਰੀਆਂ ਲੱਤਾਂ ਸਿਰ ਦਰਦ ਵੀ ਹੋਈ ਜਾਂਦਾ ਨਾਲ ਬੁਖਾਰ ਬਹੁਤ ਜ਼ਿਆਦਾ ਆ ਤਾਂ ਮੈਂ ਦਵਾਈ ਲੈਣੀ ਹੈ ਤੁਹਾਡੇ ਕੋਲੋਂ ਤਾਂ ਤੁਸੀਂ ਕਿੱਥੇ ਬੈਠਦੇ ਹੋ ਮੇਰਾ ਨਾਮ ਸਿਮਰਜੀਤ ਕੌਰ ਆ ਅਠਾਈ ਸਾਲ ਹਾਂਜੀ ਸਰ ਮੈਂ ਘਰੋਂ ਹੀ ਆਹ ਸਿਟਰਾਜੀਨ ਵਗੈਰਾ ਲਈ ਹੈ ਹਾਂਜੀ ਹਾਂਜੀ ਸਰ ਓਕੇ ਹਾਂਜੀ ਓਕੇ ਸਰ ਠੀਕ ਹੈ ਜੀ

ਠੀਕ ਹੈ ਜੀ ਠੀਕ ਹੈ ਸਰ ਹਾਂਜੀ ਸਰ ਸਵੇਰੇ ਫਿਰ ਆਜਾਂਗੀ ਓਕੇ ਥੈਂਕ ਯੂ